ਪੱਚੀ ਜਨਵਰੀ ਦੋ ਹਜ਼ਾਰ ਚਾਰ ਬਾਈ ਅਗਸਤ ਦੋ ਹਜ਼ਾਰ ਸੱਤ ਛੱਬੀ ਜੂਨ ਦੋ ਹਜ਼ਾਰ ਤੇਰਾਂ ਇੱਕੀ ਫਰਵਰੀ ਦੋ ਹਜ਼ਾਰ ਤਿੰਨ ਪੱਚੀ ਜੁ ਜੁਲਾਈ ਦੋ ਹਜ਼ਾਰ ਦਸ